ਹੈਲੋ ਹਾਂਜੀ ਹਾਂਜੀ ਵਾਟਰ ਸਪਲਾਈ ਕੰਪਨੀ ਤੋਂ ਗੱਲ ਕਰ ਰਹੇ ਹਾਂ ਜੀ ਭਾਅ ਜੀ ਭਾਅ ਜੀ ਪਿੱਛੋਂ ਦਿੱਕਤ ਆ ਰਹੀ ਹੈ ਜੀ ਵਾਰਡ ਦੀ ਜਿਹੜੀ ਸਪਲਾਈ ਨਾ ਜੀ ਉਹਦੇ ਚ ਪਾਈਪਲਾਈਨ ਜੀ ਟੁੱਟ ਗਈ ਪਿੱਛੇ ਜੀ ਕਰਕੇ ਤਾਂ ਕਰਕੇ ਉਹ ਰਿਪੇਅਰਿੰਗ ਦਾ ਵੀ ਕੰਮ ਚੱਲ ਰਿਹਾ ਅਤੇ ਉਹ ਕੁਛ ਉੱਥੇ ਪਿੱਛੇ ਦਿੱਕਤ ਵੀ ਆ ਰਹੀ ਸੀ ਪੋਰੀਫਾਈਂਗ ਦੀ ਪੋਰੀਫਾਈ ਨਹੀਂ ਆ ਰਿਹਾ ਸੀ ਸਹੀ ਤਰ੍ਹਾਂ ਹੋ ਕੇ ਤਾਂ ਉਹ ਸੀ ਉਹਦੇ ਵਿੱਚ ਥੋੜ੍ਹੇ ਜਿਹੇ ਵਿੱਚੋਂ ਗੰਦਗੀ ਜੀ ਵੀ ਆ ਰਹੀ ਸੀ ਤਾਂ ਕਰਕੇ ਉਹ ਪਿੱਛੇ ਹੁੰਦਾ ਵਾਟਰ ਪੈਰੀਫਾਈ ਦੁਬਾਰਾ ਲਗਾਇਆ ਜੀ ਉਹ ਲਗਾ ਕੇ ਅਤੇ ਉਹਦੇ 'ਤੇ ਕੰਮ ਚੱਲ ਰਿਹਾ ਜੀ ਹਜੇ

ਭਾਅ ਜੀ ਭਾਅ ਜੀ ਦੇ ਹਾਂਜੀ ਹਾਂਜੀ ਅਸੀਂ ਸਮਝ ਸਕਦੇ ਜੀ ਤੁਹਾਡੀ ਦਿੱਕਤ ਆ ਰਹੀ ਹੈ ਸਾਰਿਆਂ ਨੂੰ ਹੀ ਆ ਰਹੀ ਜੀ ਤੁਹਾਡੇ ਨਾਲ ਦਿਆਂ ਨੂੰ ਦਿੱਕਤ ਆ ਰਹੀ ਜੀ ਕੀ ਕਰੀਏ ਜੀ ਪਿੱਛੇ ਦਿੱਕਤ ਆ ਰਹੀ ਨੇ ਜੀ ਪਾਈਪਿੰਗ ਦੀ ਦਿੱਕਤ ਆ ਰਹੀ ਪਾਈਪ ਟੁੱਟ ਗਈਆਂ ਜੀ ਪਾਈਪ ਜ਼ਿਆਦਾ ਐਕਸੈਸ ਵਿੱਚ ਉਹ ਪਾਣੀ ਪ੍ਰੈਸ਼ਰ ਰਿਲੀਜ਼ ਹੋਣ ਕਰਕੇ ਉਹ ਪਾਈਪ ਟੁੱਟ ਗਈ ਜੀ ਉਹਦੇ ਰਿਪੇਅਰ ਕਾਫੀ ਜਗ੍ਹਾ ਤੋਂ ਟੁੱਟੀ ਹੈ ਜੀ ਤਾਂ ਕਰਕੇ ਉਹ ਉਹ ਰਿਪੇਅਰ ਹੋ ਰਹੀ ਹੁਣ ਹੌਲੀ ਹੌਲੀ ਰਿਪੇਅਰ ਹੋ ਰਹੀ ਹੈ ਅਤੇ ਉਹਦੇ ਵਿੱਚ ਜੀ ਇੱਕ ਤਾਂ ਵਿੱਚੋਂ ਜੀ ਆਪਣੇ ਗੰਦਗੀ ਵੀ ਆ ਗਈ ਸੀ ਪੰਨੀਆਂ ਪੁੰਨੀਆਂ ਦਾ ਵੀ ਫਸ ਗਿਆ ਸੀ ਜੀ ਤਾਂ ਕਰਕੇ ਉਹ ਨਾਲ ਨਾਲ ਰਫੇਰੀ ਉਹਦੀ ਪਿਓਰੀਫਾਈ ਦਾ ਵੀ ਕੰਮ ਚੱਲ ਰਿਹਾ ਜੀ ਤਾਂ ਕਰਕੇ ਦਿੱਕਤ ਆ ਰਹੀ ਹੈ ਜੀ ਮਾਫੀ ਚਾਹੁੰਦੇ ਹਾਂ ਜੀ ਤੁਹਾਨੂੰ ਦਿੱਕਤ ਆ ਰਹੀ ਹੈ ਜੀ ਅਸੀਂ ਇਹਦੇ ਇਹਦੇ 'ਤੇ ਕੰਮ ਕਰ ਰਹੇ ਹਾਂ ਜੀ ਹਾਂਜੀ ਹਾਂਜੀ ਭਾਅ ਜੀ ਹਾਂ ਹਾਂਜੀ ਹਾਂਜੀ ਪਿੱਛੇ ਕੰਪਨੀ ਦੇ ਗੱਲ ਹਾਂਜੀ ਹਾਂਜੀ ਭਾਅ ਜੀ ਤੁਹਾਡੀ ਗੱਲ ਸਹੀ ਹੈ ਜੀ ਪਿੱਛੇ ਗੱਲ ਚੱਲ ਰਹੀ ਹੈ ਜੀ ਕੰਪਨੀ ਦੇ ਐਂਡ 'ਤੇ ਉਹ ਗੱਲ ਕਰ ਰਹੇ ਆ ਜੀ ਉਹਨਾਂ ਨੂੰ ਇੱਕ ਤਾਂ ਉਹਨਾਂ ਨੇ ਜੀ ਡਬਲ ਕਰ ਤਾ ਜੀ ਡਬਲ ਸਪੀਡ ਨਾਲ ਕੰਮ ਕਰਤਾ ਜੀ ਕਿ ਡਬਲ ਬੰਦੇ ਲਾ ਕੇ ਅਤੇ ਕੰਮ ਕਰਾਉਣਾ ਸ਼ੁਰੂ ਕਰ ਤਾ ਜੀ ਇਹ ਹੋ ਸਕਦਾ ਜੀ ਇੱਕ ਦੋ ਦਿਨਾਂ ਦੇ ਵਿੱਚ ਤੁਹਾਨੂੰ ਦਿੱਕਤ ਆਉਣੀ ਬੰਦ ਹੋ ਜਾਵੇਗੀ ਕੰਮ ਤੇਜ਼ੀ ਨਾਲ ਕਰ ਰਿਹਾ ਜੀ ਹਾਂਜੀ ਜੀ ਵਾਟਰ ਟੈਂਕ ਦੀ ਵੀ ਇੱਕ ਸੁਵਿਧਾ ਜੀ ਕੀਤੀ ਹੈ ਜੀ ਉੱਪਰ ਐਂਡ 'ਤੇ ਉਹ ਪਾਸ ਕਰਵਾ ਕੇ ਜੀ ਕੱਲ੍ਹ ਹੋ ਸਕਦਾ ਜੀ ਤੁਹਾਡੇ ਆਪਣੇ ਕਲੋਨੀ ਦੇ ਵਿੱਚ ਜੀ ਭੇਜ ਦਾਂਗੇ ਵਾਟਰ ਟੈਂਕ ਇਹਦੇ ਨਾਲ ਤੁਹਾਨੂੰ ਦਿੱਕਤ ਨਹੀਂ ਆਵੇਗੀ ਜੀ ਦੋ ਤਿੰਨ ਦਿਨ ਦੀ ਜਿਹੜੀ ਬਸ ਹੈਗੀ ਆ ਜੀ ਮੁਸ਼ਕਿਲ ਹੋ ਜਾਵੇਗਾ ਉਸ ਤੋਂ ਬਾਅਦ ਸਹੀ ਜੀ ਫਿਰ ਤੁਹਾਨੂੰ ਪ੍ਰੋਪਰ ਮਿਲੇਗਾ ਜੀ ਪ੍ਰੋਪਰ ਵਾ ਆਉਣ ਦੀ ਵਾਟਰ ਸਪਲਾਈ ਆਵੇਗੀ ਜੀ ਹਾਂਜੀ ਹਾਂਜੀ ਭਾਅ ਜੀ ਸਮਝਦੇ ਹਾਂ ਜੀ ਸਾਰੇ ਦਿਨ ਦੀ ਲੋੜ ਹੈ ਜੀ ਪਾਣੀ ਪਾਣੀ ਬਿਨਾਂ ਜੀ ਕੰਮ ਨਹੀਂ ਚੱਲਣਾ ਤਾਂ ਕਰਕੇ ਕੋਈ ਨਹੀਂ ਭਾਅ ਜੀ ਅਸੀਂ ਉੱਪਰ ਗੱਲ ਕਰਕੇ ਜਿੰਨੀ ਜਲਦੀ ਹੋ ਸਕਦਾ ਜੀ ਇਹਨੂੰ ਜਲਦੀ ਤੋਂ ਜਲਦੀ ਸਹੀ ਕਰਵਾਉਂਦੇ ਹਾਂ ਤਾਂ ਕਿ ਆਉਣ ਵਾਲੇ ਟਾਈਮ 'ਚ ਵੀ ਤੁਹਾਨੂੰ ਦਿੱਕਤ ਨਾ ਆਵੇ ਉਹਦੇ ਲਈ ਜੀ ਮਾਫੀ ਚਾਹਦੇ ਆ ਜਿਹੜੀ ਤੁਹਾਨੂੰ ਦਿੱਕਤ ਆ ਰਹੀ ਹੈ ਜੀ ਹਾਂਜੀ ਹਾਂਜੀ ਜਲਦੀ ਤੋਂ ਜਲਦੀ ਜੀ ਭਾਅ ਜੀ ਤੁਹਾਡਾ ਆਹ ਕੰਮ ਸਹੀ ਕਰਾ ਦੇਣਾ ਜੀ ਵਾਟਰ ਸਪਲਾਈ ਵਾਲਾ ਜੀ